ਤਰਨ ਤਾਰਨ ਜ਼ਿਲ੍ਹੇ ਵਿੱਚ ਮਨਾਏ ਜਾਣ ਵਾਲੇ ਮੁੱਖ ਸੱਭਿਆਚਾਰਕ ਤਿਉਹਾਰ ਬਹੁਤ ਸਾਰੇ ਹਨ ਜਿਵੇਂ ਕਿ ਦਿਵਾਲੀ ਦਿਵਾਲੀ ਵਾਲੇ ਦਿਨ ਦੀਪਮਾਲਾ ਕਰਨੀ ਮਠਿਆਈਆਂ ਖਾਣੀਆਂ ਪਟਾਕੇ ਚਲਾਉਣੇ ਬਹੁਤ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਹੋਲੀ ਹੋਲੀ ਨੂੰ ਅਸੀਂ ਇੱਕ ਦੂਜੇ ਨੂੰ ਰੰਗ ਵੱਖੋ ਵੱਖ ਤਰ੍ਹਾਂ ਦੇ ਰੰਗ ਲਾ ਕੇ ਹੋਲੀ ਬੜੇ ਢੰਗ ਨਾਲ ਸ਼ੋਰ ਸ਼ਰਾਬੇ ਨਾਲ ਮਨਾਈ ਜਾਂਦੀ ਹੈ ਵਿਸਾਖੀ ਵੀ ਇਸ ਤਰ੍ਹਾਂ ਕਿਸਾਨਾਂ ਲਈ ਬਹੁਤ ਮਹੱਤਵ ਰੱਖਦੀ ਹੈ ਜਨਮ ਅਸ਼ਟਮੀ ਵਾਲੇ ਦਿਨ ਜਨਮ ਅਸ਼ਟਮੀ ਵਾਲੇ ਦਿਨ ਕ੍ਰਿਸ਼ਨ ਭਗਵਾਨ ਜੀ ਦੀ ਪੂਜਾ ਕੀਤੀ ਜਾਂਦੀ ਹੈ ਆਪੋ ਆਪਣੇ ਘਰਾਂ ਵਿੱਚ ਛੋਟੇ ਛੋਟੇ ਬਾਲਕਾਂ ਨੂੰ ਕ੍ਰਿਸ਼ਨ ਜੀ ਦਾ ਰੂਪ ਦਿੱਤਾ ਜਾਂਦਾ ਹੈ ਕੰਨਿਆ ਨੂੰ ਰਾਧਾ ਜੀ ਦਾ ਰੂਪ ਦਿੱਤਾ ਜਾਂਦਾ ਹੈ ਬਹੁਤ ਸੋਹਣੇ ਢੰਗ ਨਾਲ ਜਨਮ ਅਸ਼ਟਮੀ ਮਨਾਈ ਜਾਂਦੀ ਹੈ ਨਗਰ ਕੀਰਤਨ ਗੁਰਪੁਰਬ ਵਾਲੇ ਦਿਨ ਬਹੁਤ ਸੋਹਣੇ ਢੰਗ ਨਾਲ ਨਗਰ ਕੀਰਤਨ ਦਰਬਾਰ ਸਾਹਿਬ ਵਿੱਚ ਸਜਾਇਆ ਜਾਂਦਾ ਹੈ ਮੱਸਿਆ ਬਹੁਤ ਧੂਮ ਧਾਮ ਨਾਲ ਤਰਨ ਤਾਰਨ ਦੇ ਗੁਰਦੁਆਰੇ ਦੀ ਮਨਾਈ ਜਾਂਦੀ ਹੈ ਅਤੇ ਸੁੱਖਨਾ ਵੀ ਪੂਰੀਆਂ ਹੁੰਦੀਆਂ ਹਨ ਲੋਹੜੀ ਵਾਲੇ ਲੋਹੜੀ ਲੋਹੜੀ ਵੀ ਬਹੁਤ ਅੱਛੇ ਢੰਗ ਨਾਲ ਮਨਾਈ ਜਾਂਦੀ ਹੈ ਕ੍ਰਿਸਮਸ ਕ੍ਰਿਸਮਸ ਪੱਚੀ ਦਿਸੰਬਰ ਵਾਲੇ ਦਿਨ ਕ੍ਰਿਸਮਸ ਵੀ ਬਹੁਤ ਸੋਹਣੇ ਢੰਗ ਨਾਲ ਮਨਾਈ ਜਾਂਦੀ ਹੈ ਇਸ ਤਰ੍ਹਾਂ ਸਾਰੇ ਧਰਮਾਂ ਆਪੋ ਆਪਣੇ ਆਪੋ ਆਪਣੇ ਸੋਹਣੇ ਢੰਗ ਨਾਲ ਮਨਾਏ ਜਾਂਦੇ ਹਨ